ਪਾਣੀ ਦਾ ਜਿਹੜਾ ਪ੍ਰਦੂਸ਼ਣ ਹੈ ਇਹਦੇ ਹਾਲ ਵਿੱਚ ਹੀ ਅਸੀਂ ਦੇਖਿਆ ਹੈ ਕਿ ਜਿਵੇਂ ਸਤਲੁਜ ਦਰਿਆ ਦੇ ਕੰਢੇ ਕੀ ਹੈ ਕਿ ਕੰਢੇ ਕੰਢੇ 'ਤੇ ਵੀ ਮੱਛੀਆਂ ਜਿਹੜੀਆਂ ਹੁੰਦੀਆਂ ਹੈ ਪਰ ਇਹਨਾਂ ਦੇ ਨਾਲ ਕੀ ਜਿਹੜੀਆਂ ਫੈਕਟਰੀਆਂ ਹੈ ਉਹਨਾਂ ਦਾ ਗੰਦਾ ਪਾਣੀ ਆਉਂਦਾ ਏ ਜਿਹਦੇ ਕਰਕੇ ਪਿੱਛੇ ਜਿਹੇ ਕਾਫੀ ਜਿਹੜੀਆਂ ਮੱਛੀਆਂ ਸੀ ਇੱਕ ਚੋਆ ਸੀ ਉਹਦੇ ਵਿੱਚ ਗੰਦੇ ਪਾਣੀ ਦਾ ਵਹਾਅ ਹੋਣ ਕਰਕੇ ਜਿਹੜੀਆਂ ਬਹੁਤ ਸਾਰੀਆਂ ਜਿਹੜੀਆਂ ਮੱਛੀਆਂ ਸੀਗੀਆਂ ਉਹ ਮਰ ਗਈਆਂ ਸੀਗੀਆਂ ਠੀਕ ਹੈ ਇੱਕ ਤਾਂ ਇਹਦੇ ਕਰਕੇ ਮੱਛੀਆਂ ਦਾ ਕੀ ਹੈ ਖਾਤਮਾ ਹੋ ਰਿਹਾ ਹੈ ਦੂਜਾ ਕੀ ਹੈ ਕਿ ਲੋਕ ਆਪਣਾ ਭੋਜਨ ਬਣਾਉਣ ਲਈ ਵੱਧ ਤੋਂ ਵੱਧ ਕੀ ਹੈ ਜਿਹੜੀਆਂ ਮੱਛੀਆਂ ਏ ਉਹਨਾਂ ਨੂੰ ਫੜ ਰਹੇ ਹੈ ਜਾਲ ਵਿੱਚ ਆਪਣੇ ਵਿੱਚ ਅਤੇ ਕੀ ਹੈ ਅੱਗੇ ਉਹਨਾਂ ਦੀ ਸਪਲਾਈ ਕਰ ਰਹੇ ਆ ਸਾਨੂੰ ਕੀ ਹੈ ਕਿ ਜਿਹੜੀਆਂ ਇਹ ਮੱਛੀਆਂ ਏ ਇਹਨਾਂ ਬਾਰੇ ਵੀ ਇਹਨਾਂ ਦੀ ਸੰਭਾਲ ਬਾਰੇ ਸਾਨੂੰ ਸੋਚਣਾ ਚਾਹੀਦਾ ਏ ਕਿ ਜ਼ਿਆਦਾ ਤੋਂ ਜ਼ਿਆਦਾ ਕੀ ਹੈ ਜਿਹੜੀ ਏ ਮੱਛੀ ਪਾਲਣ ਸਾਨੂੰ ਖੋਲ੍ਹਣੇ ਚਾਹੀਦੇ ਹੈ ਕਿਉਂਕਿ ਜਿਹੜੀਆਂ ਇਹ ਮੱਛੀਆਂ ਹੈ ਇਹ ਵੀ ਪਾਣੀ ਵਿੱਚ ਕੀ ਹੈ ਸਾਡੀਆਂ ਇੱਕ ਮਿੱਤਰ ਦੇ ਵਾਂਗ ਹੀ ਸਾਡੇ ਨਾਲ ਯੋਗਦਾਨ ਬਣਾਉਂਦੀਆਂ ਏ ਇਸ ਲਈ ਕੀ ਹੈ ਜਿਹੜੀਆਂ ਇਹ ਮੱਛੀਆਂ ਹੈ ਇਹਨਾਂ ਦੀ ਜਿਹੜੀ ਸੰਭਾਲ ਹੈ ਉਹ ਬਹੁਤ ਜ਼ਰੂਰੀ ਹੈ